ਸ਼ੋਸ਼ਲ ਮੀਡੀਆ ਔਰ ਔਨਲਾਈਨ ਪਲੇਟਫੋਮ ਹੈ ਜਿਹੜਾ ਪੰਜਾਬ ਵਿੱਚ ਸਿੱਖਿਆ ਦੇ ਵਿੱਚ ਜੋ ਭੂਮਿਕਾ ਨਿਭਾ ਰਹੇ ਆ ਉਹ ਬਿਲਕੁਲ ਹੀ ਗਲਤ ਹੈ ਇਹ ਸਿਰਫ ਇੱਕ ਮਾਰਕੀਟਿੰਗ ਦੇ ਜਿਹੜੇ ਪਰਪਸ ਦੇ ਲਈ ਹੀ ਵਰਤਿਆ ਵਰਤੇ ਜਾ ਰਹੇ ਹਨ ਔਨਲਾਈਨ ਵੀ ਜਿਹੜਾ ਪਲੇਟਫੋਮ ਰੱਖਿਆ ਹੋਇਆ ਸਿਰਫ ਇੱਕ ਮਾਰਕੀਟਿੰਗ ਕਰਨ ਲਈ ਹੈ ਕਿ ਅਸੀਂ ਜੀ ਔਨਲਾਈਨ ਜਿਹੜੀ ਚੀਜ਼ ਵੀ ਦੇ ਰਹੇ ਹਾਂ ਬੰਦੇ ਨੂੰ ਕਿ ਘਰ ਬੈਠੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਘਰ ਬੈਠੇ ਸਟੱਡੀ ਲੈ ਸਕਦੇ ਹੋ ਸਟੱਡੀ ਮਟੀਰੀਅਲ ਲੈ ਸਕਦੇ ਹੋ ਅਤੇ ਸ਼ੋਸ਼ਲ ਮੀਡੀਆ ਵੀ ਇਹ ਜਿਹੜਾ ਗਲਤ ਪ੍ਰਚਾਰ ਹੀ ਕਰ ਰਿਹਾ ਇਸ ਲਈ ਪੰਜਾਬ ਦੀ ਸਿੱਖਿਆ ਵਿੱਚ ਜਿਹੜਾ ਇਹਨਾਂ ਦਾ ਕੁਛ ਵੀ ਕੋਈ ਖਾਸ ਅੱਛਾ ਯੋਗਦਾਨ ਨਹੀਂ ਹੈ